ਤੁਸੀਂ ਨਾਗਪਾਲ ਸ਼ੋਪ ਤੋਂ ਗੱਲ ਕਰ ਰਹੇ ਹੋ ਮੈਂ ਤੁਹਾਡੀ ਦੁਕਾਨ ਤੋਂ ਇੱਕ ਕੰਡੀਸ਼ਨਰ ਲੈ ਕੇ ਗਈ ਸੀ ਜੋ ਕਿ ਬਿਲਕੁਲ ਚੰਗਾ ਨਹੀਂ ਨਿਕਲਿਆ ਮੈਂ ਤੁਹਾਡੀ ਦੁਕਾਨ ਬਾਰੇ ਬਹੁਤ ਕੁਝ ਸੁਣਿਆ ਸੀ ਕਿ ਇਹ ਬਹੁਤ ਹੀ ਚੰਗਾ ਮਾਲ ਦਿੰਦੇ ਹਨ ਪਰ ਮੈਨੂੰ ਕੰਡੀਸ਼ਨਰ ਜਿਹੜਾ ਬਿਲਕੁਲ ਵੀ ਪਸੰਦ ਨਹੀਂ ਆਇਆ ਮੈਂ ਸੋਚਿਆ ਸੀ ਕਿ ਮੈਂ ਆਪਣੇ ਦੋਸਤਾਂ ਨੂੰ ਵੀ ਅਪ ਤੁਹਾਡੀ ਦੁਕਾਨ ਬਾਰੇ ਦੱਸਾਂਗੀ ਪਰ ਇਹ ਇਹੋ ਜਿਹਾ ਕੰਡੀਸ਼ਨਰ ਦੇ ਕੇ ਮੇਰੇ ਜਿਹੜੇ ਵਾਲ ਝੜੇ ਆ ਉਸ ਕਾਰਨ ਮੈਂ ਚਾਹੁੰਦੀ ਹਾਂ ਕਿ ਮੈਂ ਮੇਰਾ ਕੋਈ ਵੀ ਦੋਸਤ ਸਾਡੀ ਦੁਕਾਨ 'ਤੇ ਨਾ ਆਵੇ ਜਾਂ ਤਾਂ ਮੇਰੇ ਪੈਸੇ ਰਿਟਰਨ ਕਰੋ ਅਤੇ ਜਾਂ ਫਿਰ ਆਪਣਾ ਪ੍ਰੋਡਕਟ ਵਾਪਿਸ ਲਓ ਮੈਂ ਚਾਹੁੰਦੀ ਹਾਂ ਕਿ ਤੁਸੀਂ ਅੱਗੇ ਤੋਂ ਵੀ ਕਿਸੇ ਕਸਟਮਰ ਨਾਲ ਐਵੇਂ ਜਿਹੀ ਗ ਚੀਜ਼ ਨਾ ਕਰੋ ਕਿਉਂਕਿ ਕਿਸੇ ਕਸਟਮਰ ਦਾ ਵਿਸ਼ਵਾਸ ਤੋੜਨਾ ਬਹੁਤ ਹੀ ਗਲਤ ਗੱਲ ਹੁੰਦੀ ਹੈ ਤੁਸੀਂ ਅੱਗੇ ਤੋਂ ਆਪਣੇ ਕਸਟਮਰ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਆਪਣੇ ਸਾਰੇ ਪ੍ਰੋਡਕਟ ਦੀ ਪੂਰੀ ਪੂਰੀ ਜਾਣਕਾਰੀ ਰੱਖੋ ਤਾਂ ਕਿ ਉਹ ਐਕਸਪਾਇਰ ਵੀ ਨਾ ਹੋਵੇ ਅਤੇ ਅੱਗੇ ਤੋਂ ਤਾਂ ਹੀ ਮੈਂ ਤੁਹਾਡੀ ਦੁਕਾਨ ਤੋਂ ਚੀਜ਼ ਖਰੀਦਾਂਗੀ ਕੋਈ ਅਤੇ ਆਪਣੇ ਦੋਸਤਾਂ ਨੂੰ ਵੀ ਕਹਾਂਗੀ